ਭੰਗੜਾ ਭੰਗੜਾ ਪਾਉਣ ਲਈ ਦਿਲਜੀਤ ਦੇ ਗਾਣੇ ਬਹੁਤ ਹੀ ਵਧੀਆ ਹਨ ਜਿਹੜਾ ਮਰਜ਼ੀ ਗਾਣਾ ਲਾ ਲਓ ਦਿਲਜੀਤ ਦਾ ਤੁਹਾਡਾ ਆਪਣੇ ਆਪ ਭੰਗੜਾ ਪਾਉਣ ਨੂੰ ਦਿਲ ਕਰੇਗਾ ਆਪਣੇ ਆਪ ਤੁਹਾਡਾ ਪੈਰ ਉਠੇਗਾ ਅਤੇ ਨਾਲ ਦੀ ਨਾਲ ਸਾਡਾ ਇੰਜੋਏ ਹੁੰਦਾ ਰਹਿੰਦਾ ਅਤੇ ਨਾਲ ਦੀ ਨਾਲ ਸਾਡੀ ਐਕਸਰਸਾਈਜ਼ ਹੁੰਦੀ ਰਹਿੰਦੀ ਆ ਦਿਲਜੀਤ ਦਾ ਤੁਸੀਂ ਜਿਹੜਾ ਮਰਜ਼ੀ ਗਾਣਾ ਲਾ ਲਓ ਹਰੇਕ ਗਾਣੇ ਦੇ ਉੱਪਰ ਤੁਹਾਡਾ ਆਪਣੇ ਆਪ ਨੱਚਣ ਨੂੰ ਭੰਗੜਾ ਪਾਉਣ ਨੂੰ ਦਿਲ ਕਰੇਗਾ